ਕਰੋਨਾ ਮਹਾਂਮਾਰੀ ਦੇ ਦੌਰਾਨ ਸਾਡੇ ਇਲਾਕੇ 'ਤੇ ਬਹੁਤ ਬੁਰਾ ਪ੍ਰਭਾਵ ਪਿਆ ਲੋਕਾਂ ਨੂੰ ਅੰਦਰ ਅੰਦਰ ਬੰਦ ਕੀਤਾ ਗਿਆ ਅਤੇ ਸਾਰਿਆਂ ਨਾਲੋਂ ਬਹੁਤ ਬੁਰਾ ਵਿਵਹਾਰ ਕੀਤਾ ਗਿਆ ਸਾਡੇ ਆਉਣ ਜਾਣ ਦੇ ਜੋ ਕਿ ਧਾਰਮਿਕ ਅਸਥਾਨ ਸੀ ਉਹਨਾਂ 'ਤੇ ਪਾਬੰਦੀਆਂ ਲਾਈਆਂ ਗਈਆਂ ਸੈਰ ਸਪਾਟਿਆਂ ਤਾਂ ਇੱਕ ਸਾਈਡ ਸਾਡਾ ਖਾਣ ਪੀਣ ਦਾ ਸਮਾਨ ਵੀ ਬੰਦ ਕੀਤਾ ਗਿਆ ਅਤੇ ਸਾਨੂੰ ਇਸ ਸਮੇਂ ਬਹੁਤ ਹੀ ਬੁਰੇ ਪ੍ਰਭਾਵ ਨਾਲ ਇਹ ਜ਼ਿੰਦਗੀ ਕੱਟਣੀ ਪਈ